ਹਾਂ ਸਾਡੇ ਖੇਤਰ ਵਿੱਚ ਬਹੁਤ ਸਾਰੇ ਟੈਲੀਫੋਨ ਬ੍ਰਾਂਡ ਆਏ ਹਨ ਜਿਵੇਂ ਵੀਵੋ ਓਪੋ ਐੱਮਆਈ ਅਤੇ ਐਪਲ ਸਾਡੇ ਖੇਤਰ ਵਿੱਚ ਸਭ ਤੋਂ ਜ਼ਿਆਦਾ ਪਹਿਲ ਐਪਲ ਨੂੰ ਦਿੰਦੇ ਆ ਐਪਲ ਫੋਨ ਨੂੰ ਦਿੱਤੀ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਵੀ ਇਹਦੇ ਵਿੱਚ ਬਹੁਤ ਸਾਰੇ ਫ਼ੰਕਸ਼ਨ ਨਵੇਂ ਨੇਗੇ ਇਹਦਾ ਕੈਮਰਾ ਬਹੁਤ ਸਾਫ਼ ਹੈ ਪਰ ਮੇਰੇ ਕੋਲ ਵੀਵੋ ਦਾ ਫੋਨ ਹੈਗਾ ਮੈਂ ਇਹ ਮੈਂ ਆਪਣੇ ਫੋਨ ਨਾਲ ਬਹੁਤ ਸੰਤੁਸ਼ਟ ਐਂਗੀ ਕਿਉਂਕਿ ਮੇਰੇ ਮੇਰੇ ਹਿਸਾਬ ਨਾਲ ਕਿ ਸਿਰਫ਼ ਫੋਨ ਦੇ ਵਿੱਚ ਉਹ ਕੰਮ ਦੀਆਂ ਐਪਾਂ ਹੋਣੀਆਂ ਚਾਹੀਦੀਆਂ ਨੇਗੀਆਂ ਜੋ ਸਾਨੂੰ ਚਾਹੀਦੀ ਹੈ ਜਿਵੇਂ ਅਸੀਂ ਕੁਛ ਔਨਲਾਈਨ ਮੰਗਵਾਉਣਾ ਹੋਵੇ ਕੋਈ ਕੰਮ ਕਰਨਾ ਹੋਵੇ ਜਾਂ ਸਾਡੀ ਪੜ੍ਹਾਈ ਦੇ ਰਿਲੇਟਡ ਕੋਈ ਕੰਮ ਹੋਵੇ ਇਹਦੇ ਵਿ ਇਹਦੇ ਰਾਹੀਂ ਅਸੀਂ ਫੋਨ ਰਾਹੀਂ ਅਸੀਂ ਵਪਾਰ ਕਰ ਸਕਦੇ ਹਾਂ ਇਹਦੇ ਲਈ ਮੈਨੂੰ ਕੋਈ ਆਈਫੋਨ ਦੀ ਲੋੜ ਨਹੀਂ ਹੈਗੀ ਗੀ ਮੈਂ ਸਿਰਫ਼ ਆਪਣੇ ਫੋਨ ਨਾਲ ਬਹੁਤ ਸੰਤੁਸ਼ਟ ਐਂਗੀ ਮੈਨੂੰ ਉਹ ਚੀਜ਼ਾਂ ਬਹੁ ਮੈਨੂੰ ਉਹ ਚੀਜ਼ਾਂ ਮੇਰੇ ਫੋਨ ਤੋਂ ਮਿਲ ਰਹੀਆਂ ਨੇ ਜਿਹੜੀਆਂ ਮੈਨੂੰ ਚਾਹੀਦੀਆਂ ਨੇਗੀਆਂ ਅਤੇ ਇਹ ਚੀਜ਼ ਨਾਲ ਮੈਂ ਬਹੁਤ ਸੰਤੁਸ਼ਟ ਆਂਗੀ ਮੈਨੂੰ ਆਈਫੋਨ ਦੀ ਕੋਈ ਲੋੜ ਨਹੀਂ ਹੈਗੀ ਗੀ ਧੰਨਵਾਦ